ਹਾਂਜੀ ਸਾਨੂੰ ਪਾਣੀ ਦੀ ਸਪਲਾਈ ਮਿਲਦੀ ਹੈ ਸਾਡੇ ਘਰ ਪਾਣੀ ਟੂਟੀਆਂ ਰਾਹੀਂ ਟੂਟੀ ਦਾ ਪਾਣੀ ਆਉਂਦਾ ਹੈ ਇਹ ਪਾਣੀ ਪਹਿਲਾਂ ਇੰਨਾਂ ਸਾਫ ਨਹੀਂ ਆਉਂਦਾ ਸੀ ਪਰ ਹੁਣ ਟਾਈਮ ਬਹੁਤ ਫੋਰਵਰਡ ਹੋ ਗਿਆ ਹੈ ਲਗਭਗ ਸਾਰੇ ਘਰਾਂ ਵਿੱਚ ਵੈਸੇ ਤਾਂ ਆਰਓ ਲੱਗੇ ਹੋਏ ਹਨ ਪਰ ਨਵੀਂ ਟੈਕਨੋਲੋਜੀ ਆਉਣ ਕਰਕੇ ਹਰ ਘਰ ਵਿੱਚ ਟੂਟੀ ਦਾ ਪਾਣੀ ਫਿਲਟਰ ਹੋ ਕੇ ਆਉਂਦਾ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੈ ਸਗੋਂ ਰੋਜ਼ਾਨਾ ਜ਼ਿੰਦਗੀ ਵਿੱਚ ਲਾਭ ਹੀ ਹੋਇਆ ਹੈ ਪਰ ਸਾਡੀ ਜੀਵਨ ਪ੍ਰਭਾਵਿਤ ਜ਼ਰੂਰ ਹੋਇਆ ਪ੍ਰੰਤੂ ਲਾਭਦਾਇਕ ਹੈ ਪਹਿਲਾਂ ਸਾਨੂੰ ਪਾਣੀ ਲੈਣ ਲਈ ਬਾਹਰ ਜਾਣਾ ਪੈਂਦਾ ਸੀ ਪਰ ਹੁਣ ਘਰ ਵਿੱਚ ਟੂਟੀ ਰਾਹੀਂ ਪਾਣੀ ਆਉਂਦਾ ਹੈ ਜਿਸ ਨਾਲ ਸਭ ਤੋਂ ਵੱਧ ਫਾਇਦਾ ਇਹ ਹੈ ਕਿ ਸਾਡਾ ਟਾਈਮ ਵੇਸਟ ਨਹੀਂ ਹੁੰਦਾ ਜਿੰਨਾ ਟਾਈਮ ਪਾਣੀ ਲਿਆਉਣ ਵਿੱਚ ਲੰਘ ਜਾਂਦਾ ਸੀ ਓਨਾ ਟਾਈਮ ਵਿੱਚ ਅਸੀਂ ਕੋਈ ਹੋਰ ਕੰਮ ਕਰ ਲੈਂਦੇ ਹਾਂ ਇਸ ਤਰ੍ਹਾਂ ਸਾਨੂੰ ਇਸ ਦਾ ਫਾਇਦਾ ਹੈ